ਮੈਂ ਟੀਚਰ ਹਾਂ ਬੱਚਿਆਂ ਨੂੰ ਪੜ੍ਹਾਉਂਦੀ ਹਾਂ ਅਧਿਆਪਕ ਹਾਂ ਮੈਂ ਸਕੂਲ ਦੇ ਵਿੱਚ ਗਿਆਰ੍ਹਵੀਂ ਅਤੇ ਬਾਰ੍ਹਵੀਂ ਕਲਾਸ ਦੇ ਬੱਚਿਆਂ ਨੂੰ ਵੀ ਪੜ੍ਹਾਇਆ ਹੋਇਆ ਹੈ ਅਤੇ ਮੈਂ ਆਪਣੀ ਪੜ੍ਹਾਈ ਬੀਐੱਡ ਕੀਤੀ ਹੈ ਸਭ ਤੋਂ ਪਹਿਲਾਂ ਮੈਂ ਐਨ ਟੀ ਟੀ ਕੀਤੀ ਸੀ ਨਰਸਰੀ ਦੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਫਿਰ ਮੈਂ ਅੱਗੇ ਵਧਾਇਆ ਆਪਣੀ ਐਜੂਕੇਸ਼ਨ ਨੂੰ ਅਤੇ ਮੈਂ ਈ ਟੀ ਟੀ ਕੀਤੀ ਈ ਟੀ ਟੀ ਰਾਹੀਂ ਮੈਂ ਅੱਠਵੀਂ ਤੱਕ ਦੇ ਬੱਚਿਆਂ ਨੂੰ ਪੜ੍ਹਾ ਸਕਦੀ ਸੀ ਫਿਰ ਮੈਂ ਬੀਐੱਡ ਵੀ ਕੀਤੀ ਹੈ ਅਤੇ ਹੁਣ ਮੈਂ ਕਿਉਂਕਿ ਮੈਂ ਐਮ ਕੋਮ ਕੀਤੀ ਹੋਈ ਹੈ ਇਸ ਕਰਕੇ ਮੈਂ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੇ ਕਮਰਸ ਕਲਾਸ ਦੇ ਬੱਚਿਆਂ ਨੂੰ ਪੜ੍ਹਾਉਂਦੀ ਹਾਂ ਮੇਰਾ ਜਿਹੜਾ ਐਕਸਪੀਰੀਅਨਸ ਰਿਹਾ ਆਪਣੀ ਨੌਕਰੀ ਬਾਰੇ ਪੜ੍ਹਾਈ ਬਾਰੇ ਉਹ ਬਹੁਤ ਵਧੀਆ ਰਿਹਾ ਹੁਣ ਜਿਵੇਂ ਜਿਵੇਂ ਮੈਂ ਪੜ੍ਹਦੀ ਗਈ ਆਪਣੀ ਨੌਕਰੀ ਨੂੰ ਵਧਾਉਂਦੀ ਰਹੀ ਆਪਣੇ ਐਕਸਪੀਰੀਅਨਸ ਵਧਾਉਂਦੀ ਰਹੀ ਹਾਂ ਉਵੇਂ ਉਵੇਂ ਅਲੱਗ ਅਲੱਗ ਥਾਂ 'ਤੇ ਅਲੱਗ ਅਲੱਗ ਬੱਚਿਆਂ ਨੂੰ ਪੜ੍ਹਾ ਕੇ ਉਹਦਾ ਐਕਸਪੀਰੀਅਨਸ ਵੀ ਅਲੱਗ ਹੈ ਛੋਟੇ ਬੱਚਿਆਂ ਨਾਲ ਜਦੋਂ ਪੜ੍ਹਾਉਣਾ ਆਪਾਂ ਉਹਨਾਂ ਨੂੰ ਸਮਝਾਉਣਾ ਬਿਲਕੁਲ ਉਹਨਾਂ ਦੇ ਨਾਲ ਮਿਕਸ ਅੱਪ ਹੋ ਜਾਣਾ ਜਿਵੇਂ ਉਹ ਬੋਲਦੇ ਹੈ ਕਿਵੇਂ ਉਹਨਾਂ ਨੂੰ ਸਮਝ ਆਏਗਾ ਐਕਸ਼ਨ ਕਰਨਾ ਆਪਾਂ ਗੱਲਾਂ ਕਰਨੀਆਂ ਉਹਨਾਂ ਨਾਲ ਹੈਨਾ ਅਤੇ ਫਿਰ ਜਿਵੇਂ ਦੂਜੀ ਕਲਾਸ 'ਚ ਜਾਣਾ ਬੱਚਿਆਂ ਨੂੰ ਉਸ ਟੌਪਿਕ ਬਾਰੇ ਪੂਰੀ ਗਹਿਰਾਈ ਨਾਲ ਦੱਸਣਾ ਸਮਝਾਉਣਾ ਕਿ ਕੀ ਹੈ ਅਸੀਂ ਇਸ ਬਾਰੇ ਕਿਉਂ ਗੱਲ਼ ਕਰ ਰਹੇ ਹਾਂ ਅਤੇ ਕਮਰਸ ਵਾਲਿਆਂ ਬੱਚਿਆਂ ਤਾਂ ਬਿਲਕੁਲ ਹੀ ਵਪਾਰ ਬਾਰੇ ਸਮਝਾਉਣਾ ਬਿਜ਼ਨਸ ਬਾਰੇ ਕਿ ਜੇ ਇਹ ਟਰਾਂਜ਼ੈਕਸ਼ਨ ਹੋਈ ਜੇ ਇਹ ਕੰਮ ਹੋਇਆ ਅਤੇ ਕਿਉਂ ਹੋਇਆ ਜੇ ਅਸੀਂ ਅਕਾਊਂਟਸ ਕਰਨ ਲੱਗੇ ਅਕਾਊਂਟਸ ਦਾ ਲੇਖਾ ਕਰਨ ਲੱਗੇ ਹਾਂ ਤਾਂ ਆਪਣੀ ਕਾਪੀਆਂ ਦੇ ਵਿੱਚ ਅਸੀਂ ਆਪਣਾ ਰਿਕੋਰਡ ਕਿਵੇਂ ਰੱਖ ਸਕਦੇ ਹਾਂ ਕਿਵੇਂ ਕੀ ਚੀਜ਼ ਕਿੱਦਾਂ ਡੈਬਿਟ ਹੋਏਗੀ ਕਿੱਦਾਂ ਕ੍ਰੈਡਿਟ ਹੋਏਗੀ ਆਪਣੇ ਕੋਲ ਸਹੀ ਰਿਕੋਰਡ ਕਿ ਅਸੀਂ ਜੇ ਦੇਖਣਾ ਚਾਹੀਏ ਕਿ ਸਾਡੇ ਕੋਲ ਕਿੰਨੇ ਪੈਸੇ ਜੇਬ੍ਹ 'ਚ ਬਚਦੇ ਹੈ ਕਿੰਨੇ ਪੈਸੇ ਸਾਡੇ ਖਾਤਿਆਂ 'ਚ ਹੈਗੇ ਹੈ ਤਾਂ ਉਹ ਦੇਖਣ ਦਾ ਸਭ ਤੋਂ ਵਧੀਆ ਤਰੀਕਾ ਅਕਾਊਂਟ ਹੈ ਚਾਹੇ ਤਾਂ ਉਹ ਅਸੀਂ ਕੰਪਿਊਟਰ ਰਾਹੀਂ ਟੈਲੀ ਕਰੀਏ ਚਾਹੇ ਅਸੀਂ ਆਪਣੀ ਕਿਤਾਬਾਂ ਦੇ ਵਿੱਚ ਬੇਲੈਂਸ ਸ਼ੀਟ ਬਣਾ ਕੇ ਕਰੀਏ ਤਾਂ ਇਹ ਸਭ ਮੈਂ ਇੱਕ ਅਧਿਆਪਕ ਹਾਂ ਅਤੇ ਅਧਿਆਪਕ ਦੇ ਰਾਹੀਂ ਬੱਚਿਆਂ ਨੂੰ ਪੜ੍ਹਾਉਣਾ ਬਹੁਤ ਵਧੀਆ ਲੱਗਦਾ ਹੈ